ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਅ ਜੀ ਕੀ ਹਾਲ ਚਾਲ ਆ ਜੀ ਭਾਅ ਜੀ ਤੁਹਾਡੇ ਕੋਲੋ ਮੈਂ ਪੰਦਰਾਂ ਦਿਨ ਪਹਿਲਾਂ ਨੋਇਸ ਦੇ ਹੈੱਡਫ਼ੋਨ ਮੰਗਾਏ ਅਤੇ ਜੀ ਕਾਲੇ ਰੰਗ ਦੇ ਅਤੇ ਉਹ ਭਾਅ ਜੀ ਟਾਈਮ ਸਿਰ ਮੇਰੇ ਕੋਲ ਪੁੱਜ ਗਏ ਜੀ ਬਹੁਤ ਵਧੀਆ ਕੁਆਲਿਟੀ ਆ ਜੀ ਉਹਨਾਂ ਦੀ ਵੋਆਇਸ ਦੀ ਕੁਆਲਿਟੀ ਵੀ ਬਹੁਤ ਵਧੀਆ ਏ ਜੀ ਅਤੇ ਜਿਹੜੀ ਓਹਦੀ ਚਾਰਜਿੰਗ ਟਾਈਮ ਆ ਉਹ ਵੀ ਬਹੁਤ ਲੰਬੇ ਸਮੇਂ ਦੇ ਲਈ ਚੱਲਦਾ ਏ ਅਤੇ ਬਹੁਤ ਜ਼ਿਆਦਾ ਜਲਦੀ ਚਾਰਜ ਹੋ ਜਾਂਦੇ ਆ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਹੈੱਡਫ਼ੋਨ ਨੇ ਅਤੇ ਜਿੰਨੇ ਵੀ ਮੇਰੇ ਹੋਰ ਦੋਸਤ ਨੇ ਮੈਂ ਇਹਨਾ ਦੇ ਦੁਆਰਾ ਇਹਨਾਂ ਥੋਂ ਇਹੀ ਸੁਜੇਸਟ ਕਰੂੰਗਾ ਜੀ ਆਹੀ ਹੈੱਡਫ਼ੋਨ ਸੁਜੇਸਟ ਕਰੂੰਗਾ ਨੋਈਸ ਦੇ ਅਤੇ ਕਾਲਿੰਗ ਦੇ ਵਿੱਚ ਵੀ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਵੋਆਇਸ ਆ ਰਹੀ ਆ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ